ਪੰਜਾਬੀ ਸੱਭਿਆਚਾਰ ਪੰਜਾਬ ਦਾ ਸਭ ਤੋਂ ਸੋਹਣਾ ਸੱਭਿਆਚਾਰ ਹੈ ਪੰਜਾਬੀ ਸੱਭਿਆਚਾਰ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਆਉਂਦੀ ਹੈ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਪੰਜਾਬੀ ਖੇਡ ਪੰਜਾਬੀ ਰਹਿਣ ਸਹਿਣ ਪੰਜਾਬੀ ਲੋਕ ਨਾਚ ਪੰਜਾਬੀ ਗੀਤ ਪੰਜਾਬੀ ਪੰਜਾਬੀ ਸੱਭਿਆਚਾਰ ਵਿੱਚ ਆਉਂਦੇ ਹਨ ਪੰਜਾਬੀ ਸੱਭਿਆਚਾਰ ਵਿੱਚ ਅੱਜ ਅਸੀਂ ਪੰਜਾਬੀ ਫੁੱਲਕਾਰੀ ਦੀ ਗੱਲ ਕਰਾਂਗੇ ਪੰਜਾਬੀ ਵੇਸ਼ਭੁਸ਼ਾ ਜਾਂ ਪੰਜਾਬੀ ਰਹਿਣ ਸਹਿਣ ਵਿੱਚ ਪੰਜਾਬੀ ਫੁੱਲਕਾਰੀ ਪੰਜਾਬੀ ਫੁੱਲਕਾਰੀ ਕੱਪੜਿਆਂ ਵਿੱਚ ਆਉਂਦਾ ਹੈ ਜੋ ਕਿ ਚੁੰਨੀ ਇੱਕ ਦੁਪੱਟੇ ਵਿੱਚ ਪੰਜਾਬ ਫੁੱਲਾਂ ਦੀ ਕਢਾਈ ਕੀਤੀ ਜਾਂਦੀ ਹੈ ਉਹ ਹੈ ਪੰਜਾਬੀ ਫੁੱਲਕਾਰੀ ਕ ਅਖਵਾਉਂਦੀ ਹੈ ਪੰਜਾਬੀ ਫੁੱਲਕਾਰੀ ਅਲੱਗ ਅਲੱਗ ਅਤੇ ਸੋਹਣੇ ਸੋਹਣੇ ਰੰਗਾਂ ਅਤੇ ਧਾਗਿਆਂ ਨਾਲ ਕੀਤੀ ਜਾਂਦੀ ਹੈ ਪੰਜਾਬ ਵਿੱਚ ਪੰਜਾਬੀ ਪੰਜਾਬੀ ਫੁੱਲਕਾਰੀ ਵਾਲੇ ਦੁਪੱਟੇ ਬਹੁਤ ਹੀ ਚੱਲਦੇ ਹਨ ਇਹ ਪੰਜਾਬੀ ਫੁੱਲਕਾਰੀ ਵਿੱਚ ਪੰਜਾਬੀ ਦੁਪੱਟੇ ਜੋ ਹੁੰਦੇ ਹਨ ਉਹ ਭਾਰੀ ਵੀ ਹੋ ਸਕਦੇ ਹਨ ਅਤੇ ਹਲਕੇ ਵੀ ਹੋ ਸਕਦੇ ਹਨ ਅਸੀਂ ਜਿਸ ਤਰ੍ਹਾਂ ਦੀ ਫੁੱਲਕਾਰੀ ਖਰੀਦਾਂਗੇ ਸਾਨੂੰ ਉਸੀ ਤਰ੍ਹਾਂ ਦਾ ਤਾਂ ਰੇਟ ਸਾਨੂੰ ਲੱਗੇਗਾ ਮੈਂ ਬਹੁਤ ਭਾਰੀ ਪੰਜਾਬੀ ਫੁੱਲਕਾਰੀ ਖਰੀਦੀ ਸੀ ਜੋ ਕਿ ਬਹੁਤ ਹੀ ਸੋਹਣੀ ਸੀ ਹਾਂ ਕਿ ਸਾਨੂੰ ਪੰਜਾਬੀ ਫੁੱਲਕਾਰੀ ਵਾਲੇ ਦੁਪੱਟੇ ਥੋੜ੍ਹਾ ਭਾਰੀ ਦੁਪੱਟੇ ਥੋੜ੍ਹਾ ਸੰਭਾਲਣੇ ਔਖੇ ਹੋ ਜਾਂਦੇ ਹਨ ਪਰ ਭਾਰੀ ਫੁੱਲਕਾਰੀ ਬਹੁਤ ਹੀ ਸੋਹਣੀ ਲੱਗਦੀ ਹੈ ਕਿਉਂਕਿ ਪੰਜਾਬੀ ਫੁੱਲਕਾਰੀ ਵਿੱਚ ਅਲੱਗ ਅਲੱਗ ਰੰਗਾਂ ਦੇ ਬਣੇ ਹੋਏ ਫੁੱਲ ਜੋ ਬਹੁਤ ਹੀ ਸੋਹਣੇ ਲੱਗਦੇ ਹਨ